ਸਾਡੇ ਰਾਜ ਵਿੱਚ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਜੋ ਕਿ ਖਾਸ ਕਰਕੇ ਸਾਡੇ ਰਾਜ ਦੇ ਸੱਭਿਆਚਾਰ ਦਾ ਹਿੱਸਾ ਹਨ ਇਸਦੇ ਮੁੱਖ ਤਿਉਹਾਰਾਂ ਵਿੱਚ ਮਾਘੀ ਵਿਸਾਖੀ ਦੀਵਾਲੀ ਅਤੇ ਹੋਰ ਵੀ ਛੋਟੇ ਤਿਉਹਾਰ ਜਿਵੇਂ ਬਸੰਤ ਪੰਚਮੀ ਮਨਾਏ ਜਾਂਦੇ ਹਨ ਇਹਨਾਂ ਦੀ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਮਾਘੀ ਮੁਕਤਸਰ ਜ਼ਿਲ੍ਹੇ ਦੀ ਇੱਕ ਪ੍ਰਮੁੱਖ ਤਿਉਹਾਰ ਹੈ ਜਿਸ ਦਾ ਇਤਿਹਾਸ ਸਿੱਖ ਧਰਮ ਦੇ ਨਾਲ ਜੁੜਿਆ ਹੈ ਬਾਕੀ ਦੇਸ਼ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ ਪਰੰਤੂ ਸਾਡੇ ਰਾਜ ਦੇ ਵਿੱਚ ਇਸ ਨੂੰ ਮਾਘੀ ਦੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸ ਦਾ ਇਤਿਹਾਸ ਮੁਕਤਸਰ ਵਿਖੇ ਇੱਕ ਜੰਗ ਦੇ ਨਾਲ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਦੂਜਾ ਤਿਉਹਾਰ ਵਿਸਾਖੀ ਦਾ ਤਿਉਹਾਰ ਹੈ ਜੋ ਕਿ ਅਪ੍ਰੈਲ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਹ ਵਿਸਾਖੀ ਦਾ ਤਿਉਹਾਰ ਸਾਡੇ ਰਾਜ ਅਤੇ ਖਾਸ ਕਰਕੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਇਸ ਦੇ ਇਸ ਦਾ ਇਤਿਹਾਸ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੋਲਾਂ ਸੌ ਨੜਿੱਨਵੇ ਈਸਵੀ ਵਿੱਚ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਅਤੇ ਉਦੋਂ ਤੋਂ ਹੀ ਇਹ ਤਿਉਹਾਰ ਬਹੁਤ ਜ਼ਿਆਦਾ ਪ੍ਰਚੱਲਿਤ ਹੋਇਆ ਹੈ ਸਿੱਖ ਧਰਮ ਦੇ ਵਿੱਚ ਇਸਦੀ ਖਾਸ ਜਗ੍ਹਾ ਹੈ ਵਿਸਾਖੀ ਦਾ ਤਿਉਹਾਰ ਵੈਸੇ ਫਸਲਾਂ ਦੀ ਵਢਾਈ ਖਾਸ ਕਰਕੇ ਕਣਕ ਦੀ ਵਾਢੀ ਦੇ ਨਾਲ ਸੰਬੰਧਿਤ ਸੀ ਪਰੰਤੂ ਗੁਰੂਆਂ ਦੇ ਇਤਿਹਾਸ ਨਾਲ ਜੁੜਨ ਦੇ ਨਾਲ ਇਸ ਨੂੰ ਧਾਰਮਿਕ ਰੰਗਤ ਵੀ ਮਿਲੀ ਹੈ ਅਗਲਾ ਤਿਉਹਾਰ ਦੀਵਾਲੀ ਹੈ ਜੋ ਕਿ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੀ ਦੀਵਾਲੀ ਮੰਨੀ ਜਾਂਦੀ ਹੈ ਬਾਕੀ ਦੇਸ਼ ਦੇ ਵਿੱਚ ਦੀਵਾਲੀ ਦਾ ਇਤਿਹਾਸ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਹੈ ਪਰੰਤੂ ਸਾਡੇ ਰਾਜ ਦੇ ਵਿੱਚ ਦੀਵਾਲੀ ਦਾ ਸੰਬੰਧ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਇਸ ਦਿਨ ਸ਼੍ਰੀ ਗੁਰੂ ਹੋ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਬਵੰਜਾ ਪਹਾੜੀ ਰਾਜਿਆਂ ਨੂੰ ਛਡਵਾ ਕੇ ਲਿਆਏ ਸਨ ਇਸ ਕਰਕੇ ਇਸ ਦਿਨ ਦਾ ਖਾਸ ਕਰਕੇ ਸਿੱਖਾਂ ਦੇ ਵਿੱਚ ਇੱਕ ਵੱਡਾ ਮਹੱਤਵ ਹੈ ਇਸ ਤੋਂ ਇਲਾਵਾ ਹੋਰ ਤਿਉਹਾਰ ਬਸੰਤ ਪੰਚਮੀ ਦਾ ਹੈ ਬਸੰਤ ਪੰਚਮੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਮਨਾਈ ਜਾਂਦੀ ਹੈ ਇਸ ਦਿਨ ਬੱਚੇ ਅਤੇ ਵੱਡੇ ਪਤੰਗ ਚੜਾਉਂਦੇ ਹਨ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੇ ਇਕੱਠ ਹੁੰਦੇ ਹਨ ਇਸ ਤਰ੍ਹਾਂ ਪੰਜਾਬ ਰਾਜ ਦੇ ਇਹ ਵਿਸ਼ੇਸ਼ ਤਿਉਹਾਰ ਮਨਾਏ ਜਾਂਦੇ ਹਨ